ਅਠਾਰ੍ਹਾਂ ਸਤੰਬਰ ਦੋ ਹਜ਼ਾਰ ਤਿੰਨ ਅੱਠ ਦਸੰਬਰ ਦੋ ਹਜ਼ਾਰ ਪੰਜ ਚਾਰ ਜਨਵਰੀ ਦੋ ਹਜ਼ਾਰ ਦੋ ਵੀਹ ਫਰਵਰੀ ਦੋ ਹਜ਼ਾਰ ਛੇ ਪੱਚੀ ਨਵੰਬਰ ਦੋ ਹਜ਼ਾਰ ਇੱਕ